ਹੈਲੋ ਸਤਿ ਸ਼੍ਰੀ ਅਕਾਲ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਮੋਸਟ ਵੈਲਕਮ ਹਾਂਜੀ ਅਤੇ ਇਹਦਾ ਬਸ ਇਹੀ ਸ਼ੂਜ਼ ਨੂੰ ਆਪਣੇ ਨੂੰ ਵਧੀਆ ਤਰੀਕੇ ਨਾਲ ਤੁਸੀਂ ਪਾਓ ਉਸਨੂੰ ਵਧੀਆ ਤਰੀਕੇ ਨਾਲ ਉਸ ਨੂੰ ਸਾਫ ਸੁਥਰਾ ਰੱਖੋ ਵੀ ਸਮੇਂ ਸਮੇਂ 'ਤੇ ਉਸ ਨੂੰ ਵੀ ਵੀ ਜ਼ਿਆਦਾ ਨੋਕੀਲੇ ਚੀ ਚੀਜ਼ਾਂ ਤੋ ਬਚਾਓ ਹਾਂ ਹੈਲੋ ਜੀ ਹੋਰ ਸ਼ੁਜ ਲਈ ਤੁਸੀਂ ਆਪਣੇ ਦੇ ਘਰ ਵਿੱਚ ਵੀ ਤੁਹਾਡੇ ਕੋਲ ਸਟੈਂਡ ਆ ਉੱਥੇ ਰੱਖ ਸਕਦੇ ਹੋ ਕੋਈ ਨੀਚੇ ਕੋਈ ਖਰਾਬ ਹੋ ਜਾਂਦੇ ਕਈ ਵਾਰ ਹਾਂਜੀ ਉਹਨੂੰ ਸਮੇਂ 'ਤੇ ਸਮੇਂ ਸਿਰ ਅਗਰ ਤੁਸੀਂ ਉਹਨੂੰ ਸੂਜ ਨੂੰ ਆਪਣੀ ਨੂੰ ਬਈ ਅਗਰ ਜ਼ਿਆਦਾ ਗੰਦੇ ਹੋ ਕੇ ਤਾਂ ਉਸਨੂੰ ਤੁਸੀਂ ਉਹਨੂੰ ਸਾਫ ਕਰਨਾ ਚਾਹੁੰਦੇ ਹਾਂ ਪਾਣੀ ਵਿੱਚ ਜ਼ਿਆਦਾ ਕੋਈ ਨੋਕੀਲੀ ਚੀਜ਼ ਨਾਲ ਨਾ ਉਹਨੂੰ ਰਗੜੋ ਵੀ ਕੋਈ ਵਧੀਆ ਸਾਫ ਆ ਉਹਨੂੰ ਰਗੜ ਕੇ ਸਾਫ ਕਰੋ ਹਾਂਜੀ ਜੀ ਜੀ ਉਹ ਤਾਂ ਤੁਹਾਡੀ ਰਿਟਰਨ ਹੋ ਜਾਵੇਗੀ ਤੁਹਾਡੀ ਮਰਜ਼ੀ ਅਗਰ ਤੁਸੀਂ ਪੈਸੇ ਵਾਪਸ ਲੈਣਾ ਚਾਹੁੰਦੇ ਪੈਸੇ ਵਾਪਸ ਦੇ ਦਾਂਗੇ ਜੇ ਤੁਸੀਂ ਨਿਊ ਕੋਈ ਹੋਰ ਪੀਸ ਲੈਣਾ ਨਵੀਂ ਕੰਪਨੀ ਦਾ ਨਵੇਂ ਨਵੇਂ ਬ੍ਰਾਂਡ ਆਏ ਹੋਏ ਕਰਕੇ ਇਹ ਤੁਸੀਂ ਲੈ ਸਕਦੇ ਹੋ ਬਾਕੀ ਆਪਣੀ ਸ਼ੋਪ 'ਤੇ ਨਵੇਂ ਨਵੇਂ ਹੁਣ ਬ੍ਰਾਂਡ ਦਿਵਾਲੀ ਦਾ ਕਰਕੇ ਆਫਰ ਆਏ ਹੋਏ ਆ ਬੜੇ ਸਸਤੇ ਮਿਲ ਰਹੇ ਆ ਬੂਟ ਹੋਰ ਹੋਰ ਵੀ ਬਹੁਤ ਆਈਟਮ ਵਧੀਆ ਮਿਲ ਰਿਹਾ ਜੇਕਰ ਤੁਸੀਂ ਦੋ ਸ਼ੂਜ ਲੈਂਦੇ ਹੋ ਇਕੱਠੇ ਤਾਂ ਤੁਹਾਡੇ ਨਾਲ ਗਿਫਟ ਹੈਮਪਰ ਵੀ ਦਿੱਤਾ ਜਾਵੇਗਾ ਨਾਲ

ਜੀ ਜ਼ਰੂਰੀ ਬਾਕੀ ਸਾਡੀ ਸ਼ੋਪ 'ਤੇ ਨਿਊ ਡਿਜ਼ਾਇਨ ਲੇਟਸਟ ਡਿਜ਼ਾਇਨ ਆਏ ਆ ਨਵੇਂ ਬੂਟ ਐਡੀਡਾਸ ਕੰਪਨੀ 'ਚ ਅਤੇ ਹੋਰ ਕੋਂਪਨੀ 'ਚ ਬਹੁਤ ਆਏ ਆ ਜੇ ਇੱਕ ਵਾਰੀ ਤੁਸੀਂ ਜ਼ਰੂਰ ਸਾਡੇ ਮੌਕਾ ਦਿਓ ਜੀ ਸ਼ੋਪ 'ਤੇ ਆਫਰ ਹੈ ਜੀ ਜਿਹੜਾ ਇਕ ਸ਼ੁਜ ਆ ਜੀ ਆਈਡੀਡਾਸ ਦਾ ਕੰਪਨੀ ਦਾ ਉਹ ਬਾਰ੍ਹਾਂ ਸੌ ਤੋਂ ਸਟਾਰਟ ਆ ਉਹ ਹੁਣ ਸਿਰਫ ਦਿਵਾਲੀ ਦਾ ਕਰਕੇ ਸਾਢੇ ਸੱਤ ਸੌ ਰੁਪਏ 'ਚ ਦਿੱਤਾ ਜਾ ਰਿਹਾ ਪੱਚੀ ਪੱਚੀ ਪਰਸੈਂਟ ਡਿਸਕਾਊਂਟ 'ਤੇ ਚੱਲ ਰਿਹਾ ਜੀ ਬਾਕੀ ਸਾਡੀ ਸ਼ੋਪ 'ਤੇ ਹੁਣ ਜਿਤਨਾ ਵੀ ਅ ਅਵੇਲੇਬਲ ਆ ਬੀ ਨਵੀਂ ਡਿਜ਼ਾਇਨ ਦੇ ਉੱਤੇ ਨਾ ਉਹ ਵੀ ਤੁਸੀਂ ਲੈ ਸਕਦੇ ਹੋ ਵੀ ਆਮ ਤੌਰ 'ਤੇ ਲੇਡੀਜ ਤਿਉਹਾਰਾਂ ਦੇ ਕਰਕੇ ਆਮ ਤੌਰ 'ਤੇ ਪਾਉਂਦੀਆਂ ਨੇ

ਹਾਂਜੀ ਜੀ ਜੀ ਇੱਕ ਹੋਰ ਆਫਰ ਹੈ ਜੀ ਜੇ ਅਗਰ ਤੁਸੀਂ ਸਾਡੀ ਸ਼ੋਪ ਤੋਂ ਅਗਰ ਤੁਸੀਂ ਤਿੰਨ ਸ਼ੂਜ